ਹਾਂਜੀ ਅਸੀਂ ਮੱਧ ਪੀੜ੍ਹੀ ਦਾ ਹੀ ਹਿੱਸਾ ਹਾਂ ਅਸੀਂ ਆ ਮੱਧ ਪੀੜ੍ਹੀ ਦੇ ਹਿੱਸੇ ਵਿੱਚੋਂ ਹੀ ਵਿਚਰਦੇ ਹਾਂ ਅਸੀਂ ਪੁਰਾਣੇ ਸਮੇਂ ਦੇ ਬਜ਼ੁਰਗਾਂ ਨੂੰ ਵੀ ਮਿਲਦੇ ਹਾਂ ਅਤੇ ਉਨ੍ਹਾਂ ਕੋਲੋਂ ਪੁਰਾਣੇ ਪੰਜਾਬ ਬਾਰੇ ਬਹੁਤ ਸਾਰਾ ਗਿਆਨ ਲੈਂਦੇ ਹਾਂ ਪੁਰਾਣੇ ਬਜ਼ੁਰਗਾਂ ਤੋਂ ਗਿਆਨ ਲਿੱਤਾ ਸਾਨੂੰ ਬਹੁਤ ਹੀ ਚੰਗਾ ਲੱਗਦਾ ਹੈ ਪੁਰਾਣੇ ਸਮੇਂ ਦੇ ਬਜ਼ੁਰਗ ਸਾਨੂੰ ਪੁਰਾਣੇ ਪੰਜਾਬ ਬਾਰੇ ਬਹੁਤ ਹੀ ਸਾਰੀ ਗੱਲਾਂ ਦੱਸਦੇ ਹਨ ਉਹ ਦੱਸਦੇ ਹਨ ਕਿ ਕਿਵੇਂ ਪੁਰਾਣੇ ਸਮੇਂ ਵਿੱਚ ਪੰਜਾਬ ਵਿੱਚ ਸ਼ੁੱਧ ਪੰਜਾਬੀ ਹੀ ਬੋਲੀ ਜਾਂਦੀ ਸੀ ਪਰ ਅੱਜ ਕੱਲ੍ਹ ਅੱਜ ਦੀ ਪੀੜ੍ਹੀ ਇਹ ਸਭ ਕੁਛ ਭੁੱਲਦੀ ਜਾ ਰਹੀ ਹੈ ਅੱਜ ਕੱਲ੍ਹ ਤਾਂ ਅੱਜ ਦੀ ਪੀੜ੍ਹੀ ਨੇ ਬਸ ਨਵਾਂ ਹੀ ਕੁਛ ਚਲਾ ਦਿੱਤਾ ਹੈ ਜਿੱਧਰ ਦੇਖੋ ਸਭ ਅੰਗਰੇਜ਼ੀ ਹੀ ਬੋਲਦੇ ਹਨ ਅੱਜ ਦੀ ਪੀੜ੍ਹੀ ਤਾਂ ਆਪਣੀ ਮਾਤ ਭਾਸ਼ਾ ਪੰਜਾਬੀ ਸ਼ੁੱਧ ਪੰਜਾਬੀ ਨੂੰ ਤਾਂ ਬਿਲਕੁਲ ਹੀ ਭੁੱਲ ਗਏ ਹਨ ਸਾਰੇ ਕੁਛ ਤਾਂ ਅੰਗਰੇਜ਼ ਅੰਗਰੇਜ਼ੀ ਬੋਲਦੇ ਹਨ ਅਤੇ ਕੁਛ ਹਿੰਦੀ ਹੀ ਬੋਲਦੇ ਹਨ ਪੰਜਾਬੀ ਤਾਂ ਕੁਛ ਕੁਛ ਹੀ ਬੋਲਦੇ ਹਨ ਜੋ ਕੁਛ ਕੁਛ ਵੀ ਜੇ ਪੰਜਾਬੀ ਬੋਲਦੇ ਹਨ ਤਾਂ ਸ਼ੁੱਧ ਨਹੀਂ ਬੋਲਦੇ ਬਸ ਉਹਨਾਂ ਦੀ ਪੰਜਾਬੀ ਸੁਣ ਕੇ ਤਾਂ ਇੰਝ ਹੀ ਲੱਗਦਾ ਹੈ ਜਿਵੇਂ ਕਿ ਇਹ ਉੱਪਰ ਹੀ ਗੱਲਾਂ ਕਰ ਰਹੇ ਹਨ ਸ਼ੁੱਧ ਪੰਜਾਬੀ ਤਾਂ ਅੱਜ ਕੱਲ੍ਹ ਦੀ ਪੀੜ੍ਹੀ ਜਮੀ ਹੀ ਭੁੱਲ ਗਈ ਹੈ ਅੱਜ ਕੱਲ੍ਹ ਦੀ ਪੀੜ੍ਹੀ ਤਾਂ ਬਸ ਸਿਰਫ਼ ਬਾਹਰ ਨੂੰ ਹੀ ਭੱਜੀ ਜਾਂਦੀ ਹੈ ਅਤੇ ਆਪਣਾ ਬਸ ਅੱਗਾ ਹੀ ਦੇਖੀ ਜਾਂਦੀ ਆ ਆਪਣੇ ਪਿਛੋਕੜ ਨੂੰ ਤਾਂ ਅੱਜ ਦੀ ਪੀੜ੍ਹੀ ਜਮੀ ਹੀ ਭੁੱਲ ਗਈ ਹੈ ਅਸੀਂ ਸੋਚਦੇ ਹਾਂ ਜੇਕਰ ਅੱਜ ਦੀ ਪੀੜ੍ਹੀ ਆਪਣਾ ਅੱਗਾ ਭੁੱਲ ਆਪਣਾ ਅੱਗਾ ਦੇਖਦੇ ਹੋਏ ਆਪਣਾ ਪਿਛੋਕੜ ਭੁੱਲ ਗਈ ਹੈ ਤਾਂ ਉਹ ਇੱਕ ਦਿਨ ਆਪਣਾ ਅੱਗਾ ਵੀ ਭੁੱਲ ਜਾਏਗੀ ਸਾਨੂੰ ਸੋ ਸੋਚਣਾ ਚਾਹੀਦਾ ਹੈ ਕਿ ਪੁਰਾਣਾ ਸਮੇਂ ਵਿੱਚ ਪੰਜਾਬ ਕਿਸ ਤਰ੍ਹਾਂ ਦਾ ਸੀ ਸਾਨੂੰ ਉਸ ਤਰ੍ਹਾਂ ਹੀ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਅੱਜ ਕੱਲ੍ਹ ਦੀ ਪੀੜ੍ਹੀ ਇਹ ਸਭ ਕੁਛ ਭੁੱਲ ਹੀ ਗਈ ਹੈ ਪੁਰਾਣੇ ਸਮੇਂ ਵਿੱਚ ਤਾਂ ਪਹਿਰਾਵਾ ਵੀ ਬਹੁਤ ਹੀ ਵਧੀਆ ਹੁੰਦਾ ਸੀ ਕੁੜੀਆਂ ਅ ਪੁਰਾਣੇ ਸਮੇਂ ਵਿੱਚ ਸੂਟ ਸਲਵਾਰ ਹੀ ਪਾਉਂਦੀਆਂ ਸਨ ਪਰ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਜ ਕੁੜੀਆਂ

ਅੱਜ ਕੱਲ੍ਹ ਦੀ ਪੀੜ੍ਹੀ ਤਾਂ ਆਪਣੇ ਮਾਂ ਬਾਪ ਨੂੰ ਜਮੀ ਹੀ ਨਹੀਂ ਯਾਦ ਕਰਦੇ ਜਿਹੜੇ ਕਿ ਬੱਚੇ ਬਾਹਰ ਚਲੇ ਜਾਂਦੇ ਹਨ ਉਹ ਤਾਂ ਜ ਆਪਣੇ ਮਾਂ ਬਾਪਾਂ ਨੂੰ ਜਮੀ ਹੀ ਭੁੱਲ ਜਾਂਦੇ ਹਨ ਅਤੇ ਉਹ ਮੁੜ ਕੇ ਫੋਨ ਵੀ ਨਹੀਂ ਕਰਦੇ ਉਹਨਾਂ ਦੇ ਮਾਂ ਬਾਪ ਇਕੱਲੇ ਰਹਿ ਜਾਂਦੇ ਹਨ ਅਤੇ ਉਹ ਇਕੱਲੇ ਆਪਣੇ ਬੱਚਿਆਂ ਨੂੰ ਤਰਸਦੇ ਹਨ ਕਿ ਉਹ ਸਾਨੂੰ ਫੋਨ ਕਰੇ ਜਾਂ ਸਾਨੂੰ ਮਿਲਣ ਆਵੇ ਕਿ ਉਹਨਾਂ ਦਾ ਇਕੱਲੇ ਇਕੱਲੇ ਬੱਚੇ ਉਹਨਾਂ ਤੋਂ ਬਹੁਤ ਦੂਰ ਚਲੇ ਜਾਂਦੇ ਹਨ ਪਰ ਅੱਜ ਕੱਲ੍ਹ ਦੀ ਪੀੜ੍ਹੀ ਇਹ ਤਾਂ ਸੋਚਦੀ ਹੀ ਨਹੀਂ ਕਿ ਸਾਡੇ ਮਾਂ ਬਾਪ ਸਾਡੇ ਤੋਂ ਬਿਨਾਂ ਇਕੱਲੇ ਹਨ ਅਸੀਂ ਉਹਨਾਂ ਨੂੰ ਕਿਵੇਂ ਯਾਦ ਕਰਨਾ ਉਹਨਾਂ ਨੂੰ ਕਿਵੇਂ ਯਾਦ ਕਰੀਏ ਇਹ ਅੱਜ ਕੱਲ੍ਹ ਦੀ ਪੀੜ੍ਹੀ ਤਾਂ ਜਮੀ ਹੀ ਭੁੱਲ ਗਈ ਹੈ ਸਾਨੂੰ ਸੋਚਣਾ ਚਾਹੀਦਾ ਹੈ ਕਿ ਪੁਰਾਣੇ ਸਮੇਂ ਵਿੱਚ ਕਿਵੇਂ ਲੋਕ ਇਕੱਠੇ ਪਰਿਵਾਰ ਰਹਿੰਦੇ ਸਨ ਹਮੇਸ਼ਾ ਘਰ ਵਿੱਚ ਬਹੁਤ ਰੌਣਕਾਂ ਹੁੰਦੀਆਂ ਸਨ ਸਾਰੇ ਇਕੱਠੇ ਬੈਠਦੇ ਸਨ ਇਕੱਠੇ ਰੋਟੀ ਬਣਾ ਖਾਂਦੇ ਸਨ ਅਤੇ ਇਕੱਠੇ ਹੀ ਵਿਹੜੇ ਵਿੱਚ ਬੈਠਦੇ ਸਨ ਪੁਰਾਣੇ ਸਮੇਂ ਵਿੱਚ ਦਾ ਪੰਜਾਬ ਬਹੁਤ ਹੀ ਵਧੀਆ ਸੀ ਪੁਰਾਣੇ ਲੋਕ ਬਹੁਤ ਹੀ ਵਧੀਆ ਸਨ ਉਹ ਆਪਣੇ ਮਾਂ ਬਾਪ ਨਾਲ ਹੀ ਰਹਿੰਦੇ ਸਨ ਉਹ ਕਦੀ ਬਾਹਰ ਨਹੀਂ ਜਾਂਦੇ ਸਨ ਉਹ ਮਾਂ ਬਾਪ ਨੂੰ ਹਮੇਸ਼ਾ ਰੱਖਦੇ ਸਨ ਅਤੇ ਉਹ ਆਪਣੇ ਮਾਂ ਬਾਪ ਨਾਲ ਹੀ ਰਹਿੰਦੇ ਸਨ ਪਰ ਅੱਜ ਕੱਲ੍ਹ ਦੀ ਪੀੜ੍ਹੀ ਤਾਂ ਇਹ ਜਮਾਂ ਹੀ ਭੁੱਲ ਗਈ ਹੈ ਸਿਰਫ਼ ਪੈਸੇ ਦੇ ਪਿੱਛੇ ਹੀ ਭੱਜ ਰਹੀ ਹੈ ਸਿਰਫ਼ ਉਹਨਾਂ ਨੂੰ ਪੈਸਾ ਹੀ ਦਿਖ ਰਿਹਾ ਹੈ ਉਹਨਾਂ ਲਈ ਰਿਸ਼ਤੇ ਕੋਈ ਮਾਇਨੇ ਨਹੀਂ ਰਹੇ ਕੋਈ ਉਹਨਾਂ ਲਈ ਮਾਂ ਬਾਪ ਨਹੀਂ ਕੋਈ ਭੈਣ ਭਾਈ ਨਹੀਂ ਕੋਈ ਕੁਛ ਨਹੀਂ ਬਸ ਉਹ ਬਾਹਰ ਹੀ ਭੱਜੀ ਜਾ ਰਹੀ ਹੈ ਦੁਨੀਆ ਅਤੇ ਅੱਜ ਕੱਲ੍ਹ ਦੀ ਪੀੜ੍ਹੀ ਨੇ ਤਾਂ ਇਹ ਗੱਲ ਹੀ ਸੋਚੀ ਹੈ ਕਿ ਅਸੀਂ ਤਾਂ ਕਿਸੇ ਨੂੰ ਪੁੱਛਣਾ ਹੀ ਨਹੀਂ ਹੈ ਬਸ ਅਸੀਂ ਆਪਣਾ ਆਪ ਹੀ ਸੋਚਣਾ ਹੈ ਅੱਜ ਕੱਲ੍ਹ ਦੀ ਪੀੜ੍ਹੀ ਨੇ ਤਾਂ ਇਹੀ ਠਾਣ ਰੱਖਿਆ ਹੈ ਉਹ ਆਪਣੇ ਮਾਂ ਬਾਪ ਨੂੰ ਵੀ ਨਹੀਂ ਪੁੱਛਦੇ ਅਤੇ ਹੋਰ ਕੀ ਉਹ ਆਪਣਾ ਪਿਛੋਕੜ ਤੱਕ ਹੀ ਭੁੱਲ ਜਾਂਦੇ ਹਨ ਕਿ ਸਾਡੇ ਪਿਛੋਕੜ ਕੀ ਹੈ ਅਤੇ ਉਹ ਸਿਰਫ਼ ਅੱਗੇ ਨੂੰ ਹੀ ਭੱਜਦੇ ਰਹਿੰਦੇ ਹਨ ਅੱਜ ਕੱਲ੍ਹ ਦੀ ਪੀੜ੍ਹੀ ਵਿੱਚ ਅਤੇ ਪੁਰਾਣੇ ਟਾਈਮ ਦੇ ਸਮੇਂ ਵਿੱਚ ਬਹੁਤ ਹੀ ਅੰਤਰ ਬਹੁਤ ਜ਼ਿਆਦਾ ਅੰਤਰ ਮੰਨਿਆ ਜਾਂਦਾ ਹੈ ਉਹ ਚੰਦ ਦੇਖਿਆ ਜਾਂਦਾ ਹੈ ਕਿ ਜਿਵੇਂ ਕਿ ਪੁਰਾਣੇ ਸਮੇਂ ਵਿੱਚ ਬਜ਼ੁਰਗ ਆਪਣੀਆਂ ਗੱਲਾਂ ਦੱਸਦੇ ਹਨ ਪਰ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਉਹਨਾਂ ਕੋਲ ਬੈਠਦੀ ਹੀ ਨਹੀਂ ਉਹਨਾਂ ਤੋਂ ਦੂਰ ਹੀ ਰਹਿੰਦੀ ਹੈ ਕਿ ਅਸੀਂ ਤਾਂ ਇਹਨਾਂ ਤੋਂ ਬੈਠਣਾ ਹੀ ਨਹੀਂ ਸਾਨੂੰ ਅਸ ਅਸੀਂ ਤਾਂ ਇਹਨਾਂ ਤੋਂ ਦੂਰ ਹੀ ਰਹਿਣਾ ਇਸ ਕਰਕੇ ਉਹ ਉਹਨਾਂ ਤੋਂ ਦੂਰ ਹੀ ਰਹਿੰਦੀ ਹੈ ਆਪਣਾ ਆਪ ਹੀ ਇਹ ਘੁੰਮਦੇ ਫਿਰਦੇ ਰਹਿੰਦੇ ਹਨ ਅਤੇ ਇੱਧਰ ਉੱਧਰ ਘੁੰਮਦੇ ਰਹਿੰਦੇ ਹਨ ਅਤੇ ਇਹਨਾਂ ਦਾ ਤਾਂ ਪਹਿਰਾਵਾ ਹੀ ਬਹੁਤ ਵ ਗੰਦਾ ਹੋ ਚੁੱਕਿਆ ਹੈ ਅੱਜ ਕੱਲ੍ਹ ਦੀ ਪੀੜ੍ਹੀ ਦਾ ਅੱਜ ਕੱਲ੍ਹ ਦੀ ਪੀੜ੍ਹੀ 'ਚ ਤਾਂ ਸੰਸਕਾਰ ਨਾਮ ਦੀ ਕੋਈ ਚੀਜ਼ ਹੈ ਹੀ ਨਹੀਂ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਤਾਂ ਬੋਲਣ ਦਾ ਹੀ ਨਹੀਂ ਪਤਾ ਕਿਵੇਂ ਬੋਲਿਆ ਜਾਂਦਾ ਵੱਡਿਆਂ ਦਾ ਆਦਰ ਕਿਵੇਂ ਕਰੀਦਾ ਛੋਟਿਆਂ ਨੂੰ ਪਿਆਰ ਕਿਵੇਂ ਕਰੀਦਾ ਇਹ ਸਭ ਕੁਛ ਤਾਂ ਅੱਜ ਦੀ ਪੀੜ੍ਹੀ ਭੁੱਲ ਹੀ ਜਾ ਰਹੀ ਹੈ ਪੁਰਾਣੇ ਸਮੇਂ ਦੇ ਲੋਕ ਜਿਵੇਂ ਕਿ ਬਹੁਤ ਵਧੀਆ ਸੁਭਾਅ ਦੇ ਮੰਨੇ ਜਾਂਦੇ ਹਨ ਕਿ ਉਹਨਾਂ ਦੀ ਬੋਲੀ ਵਿੱਚ ਬਹੁਤ ਮਿਠਾਸ ਹੁੰਦੀ ਹੈ ਉਹ ਸ਼ੁੱਧ ਪੰਜਾਬੀ ਹੀ ਬੋਲਦੇ ਹਨ ਸ਼ੁੱਧ ਪੰਜਾਬੀ ਵਿੱਚ ਬਹੁਤ ਹੀ ਜ਼ਿਆਦਾ ਮਿਠਾਸ ਹੈ ਉਹਨਾਂ ਦੀ ਬੋਲੀ ਸੁਣ ਕੇ ਤਾਂ ਇੰਝ ਲੱਗਦਾ ਹੈ ਜਿਵੇਂ ਕਿ ਇਹ ਸਾਨੂੰ ਕੀਦ ਕਦੋਂ ਦੇ ਜਾਣਦੇ ਹਨ ਅਤੇ ਅਸੀਂ ਇਹਨਾਂ ਨੂੰ ਮਿਲ ਕੇ ਇੰਨਾ ਖੁਸ਼ ਹੁੰਦੇ ਹਾਂ ਅਤੇ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਤਾਂ ਬੋਲਣ ਦਾ ਬਿਲਕੁਲ ਹੀ ਨਹੀਂ ਪਤਾ ਹੁੰਦਾ ਅੱਜ ਕੱਲ੍ਹ ਦੀ ਪੀੜ੍ਹੀ ਨੇ ਤਾਂ ਜਮੀ ਹੀ ਕਹਿ ਰੱਖਿਆ ਹੈ ਕਿ ਅਸੀਂ ਤਾਂ ਕਿਸੇ ਦੀ ਗੱਲ ਸੁਣਨੀ ਹੀ ਨਹੀਂ ਹੈਗੀ ਅੱਜ ਕੱਲ੍ਹ ਦੀ ਪੀੜ੍ਹੀ ਤਾਂ ਹੱਥੋਂ ਹੀ ਬਾਹਰ ਗਈ ਹੈ ਅੱਜ ਕੱਲ੍ਹ ਦੀ ਪੀੜ੍ਹੀ ਦਾ ਬਹੁਤ ਸਾਰੇ ਨਸ਼ੇ ਵੀ ਕਰਨੇ ਸ਼ੁਰੂ ਕਰਦੇ ਹਨ ਅੱਜ ਕੱਲ੍ਹ ਦੀ ਪੀੜ੍ਹੀਆਂ ਦੇ ਜਿਹੜੀਆਂ ਕੁੜੀਆਂ ਹੁੰਦੀਆਂ ਹਨ ਉਹ ਨਸ਼ੇ ਆਮ ਤਰੀਕੇ ਦੇ ਕਰਦੀਆਂ ਹਨ ਪਿਛਲੇ ਪੰਜਾਬ ਪਿਛਲੇ ਪੁਰਾਣੇ ਸਮੇਂ ਦੀਆਂ ਔਰਤਾਂ ਹਨ ਉਹ ਬਹੁਤ ਹੀ ਸੰਸਕਾਰੀ ਮੰਨੀ ਜਾਂਦੀਆਂ ਹਨ ਉਹ ਘਰੋਂ ਬਾਹਰ ਨਹੀਂ ਜਾਂਦੀਆਂ ਸਨ ਅਤੇ ਨਸ਼ੇ ਵੀ ਨਹੀਂ ਕਰਦੀਆਂ ਸਨ ਉਹਨਾਂ ਦੀ ਬਹੁਤ ਸੰਸਕਾਰੀ ਮੰਨਿਆ ਜਾਂਦਾ ਹੈ ਇਸ ਲਈ ਪੁਰਾਣੇ ਸਮੇਂ ਵਿੱਚ ਪੰਜਾਬ ਬਹੁਤ ਵਧੀਆ ਮੰਨਿਆ ਜਾਂਦਾ ਸੀ ਅਤੇ ਅੱਜ ਦੀ ਪੀੜ੍ਹੀ ਨੇ ਤਾਂ ਪੰਜਾਬ ਦਾ ਬੇੜਾ ਗਰਕ ਕੀਤਾ ਹੋਇਆ ਹੈ